ਜਦੋਂ ਮੈਂ ਐਰੋਬਿਕ ਕਲਾਸਾਂ ਲਗਾਉਣ ਜਾਂਦਾ ਸੀ ਉਸ ਸਮੇਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਭੰਗੜੇ ਦੇ ਸਟੈਪ ਸਿਖਾਏ ਜਾਂਦੇ ਸਨ ਕਈ ਵਾਰ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਰ ਜਦੋਂ ਮੈਂ ਭੰਗੜੇ ਦੇ ਉਹ ਸਟੈਪ ਸਿੱਖ ਲਏ ਤਾਂ ਸਾਡਾ ਇੱਕ ਭੰਗੜੇ ਦਾ ਪ੍ਰਤੀਯੋਗਿਤਾ ਹੋਈ ਉਸ ਵਿੱਚ ਸਾਡੇ ਗਰੁੱਪ ਨੇ ਇੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਾਡੇ ਗਰੁੱਪ ਨੇ ਗੁਰਦਾਸ ਮਾਨ ਦੇ ਗੀਤ ਕੀ ਬਣੂ ਦੁਨੀਆ ਅਤੇ ਲੈਂਬਰਗਿਰੀ ਦੇ ਗਾਣੇ 'ਤੇ ਖੂਬ ਭੰਗੜਾ ਪਾਇਆ ਇਸ ਵਿੱਚ ਸਾਨੂੰ ਇੱਕ ਟਰਾਫੀ ਮਿਲੀ ਅਤੇ ਅਸੀਂ ਜੇਤੂ ਕਰਾਰ ਦਿੱਤੇ ਗਏ ਸਾਡਾ ਉਹਨਾਂ ਵਿੱਚੋਂ ਪਹਿਲਾ ਨੰਬਰ ਆਇਆ ਉਸ ਤੋਂ ਬਾਅਦ ਅਸੀਂ ਪਾਰਟੀ ਕੀਤੀ ਅਤੇ ਜਦੋਂ ਅਸੀਂ ਦੁਬਾਰਾ ਆਪਣੇ ਸੈਂਟਰ ਆਏ ਤਾਂ ਸਾਨੂੰ ਉਹਨਾਂ ਨੇ ਵੀ ਬਹੁਤ ਸਮ ਸਨਮਾਨ ਦਿੱਤੇ ਸਾਡੀ ਖੁਸ਼ੀਆਂ ਦਾ ਠਿਕਾਣਾ ਨਹੀਂ ਰਿਹਾ ਸਾਨੂੰ ਬਹੁਤ ਖੁਸ਼ੀਆ ਹ ਹੋਈਆਂ ਅਸ ਇਸ ਵਿੱਚ ਅਸੀਂ ਅੱਜ ਤੱਕ ਇਸ ਚੀਜ਼ ਨੂੰ ਯਾਦ ਕਰਦੇ ਹਾਂ